ਮੈਨੂੰ ਤਸਵੀਰਾਂ ਖਿੱਚਣ ਦਾ ਬਹੁਤ ਸ਼ੌਕ ਹੈ ਇਸ ਦੇ ਲਈ ਜ਼ਿਆਦਾਤਰ ਮੈਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਹੀ ਕਰਦੀ ਹਾਂ ਮੈਨੂੰ ਕੁਦਰਤ ਦੀਆਂ ਤਸਵੀਰਾਂ ਖਿੱਚਣੀਆਂ ਚੰਗੀਆਂ ਲੱਗਦੀਆਂ ਹਨ ਜਿਵੇਂ ਕਿ ਪਹਾੜਾਂ 'ਤੇ ਜਾਣ ਵੇਲੇ ਪਹਾੜਾਂ ਦੀਆਂ ਪੇੜਾਂ ਦੀਆਂ ਉੱਥੋਂ ਦੇ ਜੀਵ ਜੰਤੂਆਂ ਦੀਆਂ ਤਸਵੀਰਾਂ ਖਿੱਚਣੀਆਂ ਮੈਨੂੰ ਚੰਗੀਆਂ ਲੱਗਦੀਆਂ ਹਨ ਮੈਂ ਇਹਨਾਂ ਕੁਦਰਤੀ ਜਗਾਵਾਂ 'ਤੇ ਜਾ ਕੇ ਕੁਦਰਤ ਦੇ ਵਿੱਚ ਆਪਣੀਆਂ ਤਸਵੀਰਾਂ ਖਿੱਚਣੀਆਂ ਵੀ ਬਹੁਤ ਪਸੰਦ ਕਰਦੀ ਹਾਂ ਜਿਵੇਂ ਕਿ ਮਨਾਲੀ ਦੇ ਵਿੱਚ ਬਰਫ ਨਾਲ ਢੱਕੀਆਂ ਪਹਾੜਾਂ ਦੇ ਉੱਤੇ ਮੈਂ ਆਪਣੀਆਂ ਬਹੁਤ ਤਸਵੀਰਾਂ ਖਿੱਚੀਆਂ ਹਨ ਇਸ ਤਰ੍ਹਾਂ ਰਾਜਸਥਾਨ ਦੇ ਰੇਤੀਲੇ ਇਲਾਕਿਆਂ ਦੇ ਵਿੱਚ ਮੈਂ ਰੇਤ ਦੇ ਉੱਤੇ ਵੀ ਬਹੁਤ ਤਸਵੀਰਾਂ ਖਿੱਚੀਆਂ ਹਨ ਨੈਨੀਤਾਲ ਦੇ ਵਿੱਚ ਲੇਕ ਦੇ ਵਿੱਚ ਪਾਣੀ ਦੇ ਵਿੱਚ ਮੈਂ ਆਪਣੀਆਂ ਤਸਵੀਰਾਂ ਖਿੱਚ ਕੇ ਉਹਨਾਂ ਦੇ ਸੰਤੁਲਿਤ ਕੀਤਾ ਹੋਇਆ ਹੈ